ਹੈਲੋ ਹਾਂਜੀ ਮੈਮ ਹਾਂਜੀ ਮੈਮ ਸਤਿ ਸ਼੍ਰੀ ਅਕਾਲ ਹਾਂਜੀ ਮੈਮ ਅਸੀਂ ਜਗਬਾਣੀ ਤੋਂ ਬੋਲ ਰਹੇ ਹਾਂ ਅਤੇ ਮੈਮ ਇੱਥੇ ਤੁਸੀਂ ਦੱਸ ਸਕਦੇ ਹੋ ਵੀ ਆਪਣੇ ਪੰਜਾਬ ਵਿੱਚ ਕਿੰਨੇ ਦਰਿਆ ਕਿੰਨੇ ਨਦੀਆਂ ਦੱਸੋ ਜੀ ਮੈਂ ਥੋੜ੍ਹੀ ਜਾਣਕਾਰੀ ਲੈਣੀ ਤੁਹਾਡੇ ਤੋਂ ਹਾਂਜੀ ਹਾਂ ਤੁਸੀਂ ਪੰਜਾਬ ਅ ਆਪਣੇ ਜਗਬਾਣੀ ਨੂੰ

ਹਾਂਜੀ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਹਾਂਜੀ ਠੀਕ ਹੈ ਮੈਮ ਹਾਂਜੀ

ਜੀ ਮੈਡਮ ਜੀ ਮੈਡਮ ਮੈਮ ਤੁਸੀਂ ਜਿਵੇਂ ਪਾਣੀ ਦੇ ਬਚਾਅ ਕਰੋਗੇ ਕਿਵੇਂ ਕਰ ਸਕਦੇ ਹੋ ਹਾਂਜੀ ਹਾਂਜੀ ਹਾਂਜੀ ਹਾਂਜੀ ਸਾਨੂੰ ਪਾਣੀ ਦਾ ਬਚਾਓ ਕਰਨੀ ਵੱਧ ਤੋਂ ਵੱਧ ਬਚਾਅ ਹੋਣਾ ਚਾਹੀਦਾ

ਹਾਂਜੀ ਹਾਂਜੀ ਜੀ ਪਾਣੀ ਨਹਿਰਾਂ ਦਾ ਪਾਣੀ ਪੀਂਦੇ ਹੋ ਮੈਮ

ਹਾਂਜੀ ਠੀਕ ਹੈ ਥੈਂਕ ਯੂ ਮੈਮ ਤੁਸੀਂ ਸਾਨੂੰ ਧੰਨਵਾਦ ਬਹੁਤ ਬਹੁਤ ਤੁਹਾਡਾ ਸਾਨੂੰ ਮਾ ਨਹਿਰਾਂ ਦੇ ਪਾਣੀ ਬਾਰੇ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ